ਮੁਸ਼ਕਿਲ ਤਕਨੀਕ ਅੱਜ ਕੱਲ੍ਹ ਮਹਿੰਗਾਈ ਹੈ ਜੋ ਕਿ ਮੇਨ ਮੁੱਦਾ ਮੇਨ ਤਕਨੀਕ ਸਾਡੀ ਆਈ ਹੈ ਕਿ ਮਹਿੰਗਾਈ ਮਹਿੰਗਾਈ ਹਰ ਜਗ੍ਹਾ ਇੰਨੀ ਵੱਧ ਚੁੱਕੀ ਹੈ ਕਿ ਗਰੀਬ ਇਨਸਾਨ ਤਾਂ ਮਰਿਆ ਹੀ ਪਿਆ ਗਰੀਬ ਇਨਸਾਨ ਨੂੰ ਮਹਿੰਗਾਈ ਤੋਂ ਇੰਨੀ ਐਲਰਜੀ ਹੋ ਗਈ ਹੈ ਕਿ ਉਹ ਵਿਚਾਰਾ ਇੱਕ ਟਾਈਮ ਰੋਟੀ ਖਾ ਲੈਂਦਾ ਅਤੇ ਦੂਜੇ ਟਾਈਮ ਦੀ ਉਹਨੂੰ ਉਹ ਹੋ ਜਾਂਦੀ ਹੈ ਕਿ ਪਰਿਵਾਰ ਨੂੰ ਮੈਂ ਦੂਜੇ ਟਾਈਮ 'ਤੇ ਰੋਟੀ ਦੇ ਵੀ ਪਾਵਾਂਗਾ ਕਿ ਨਹੀਂ ਦੇ ਪਾਵਾਂਗਾ ਮਹਿੰਗਾਈ ਖਾਣਾ ਬਣਾਉਣ ਲੱਗੇ ਦੇਖੋ ਪਹਿਲੇ ਆਟਾ ਲੈ ਕੇ ਆਉਣਾ ਅਸੀਂ ਆਟਾ ਬਹੁਤ ਮਹਿੰਗਾ ਠੀਕ ਹੈ ਫਿਰ ਅਸੀਂ ਆਟਾ ਜੇ ਲੈ ਆਉਂਦਾ ਅਤੇ ਉਹਨੂੰ ਬਣਾਉਣ ਵਾਸਤੇ ਸਲਿੰਡਰ ਜਿਹਦੀ ਉਪਯੋਗਤਾ ਸੀ ਸਭ ਤੋਂ ਜ਼ਿਆਦਾ ਕਰ ਰਹੇ ਹਾਂ ਅੱਜ ਕੱਲ੍ਹ ਸਿਲੰਡਰ ਹਰ ਘਰ ਘਰ ਵਿੱਚ ਸਿਲੰਡਰ ਮੌਜੂਦ ਨੇ ਸਿਲਿੰਡਰ ਸਲਿੰਡਰ ਹੀ ਇੰਨਾਂ ਮਹਿੰਗਾ ਕਿ ਬੰ ਇਨਸਾਨ ਪਰੇਸ਼ਾਨ ਹੈ ਲੈ ਲੈਂਦਾ ਤਾਂ ਨਹੀਂ ਲੈਂਦਾ ਤਾਂ ਉਦੋਂ ਪਰੇਸ਼ਾਨ ਹੈ ਮਹਿੰਗਾਈ ਦਾ ਸਭ ਤੋਂ ਵੱਡਾ ਤਾਂ ਰੀਜਨ ਆਹੀ ਹੋ ਗਿਆ ਕਿ ਅਸੀਂ ਖਾਣਾ ਖਾਣ ਤੋਂ ਵੀ ਮਹਿੰਗਾਈ ਤੋਂ ਪਰੇਸ਼ਾਨ ਅੱਗੇ ਲੋਕ ਚੰਗਾ ਫਰੂਟ ਖਾਂਦੇ ਸੀਗੇ ਹੁਣ ਮਹਿੰਗਾਈ ਕਰਕੇ ਫਰੂਟ ਵੀ ਇੰਨਾਂ ਮਹਿੰਗਾ ਹੋ ਗਿਆ ਨਾ ਹੀ ਉਹਨਾਂ ਵਿੱਚ ਕੋਈ ਤੱਤ ਰਹੇ ਆ ਅੱਜ ਕੱਲ੍ਹ ਮਹਿੰਗਾਈ ਕਾਰਨ ਫਰੂਟਾਂ ਨੂੰ ਵੀ ਟੀਕੇ ਲਾ ਲਾ ਕੇ ਤਿਆਰ ਕਰਨ ਦਾ ਉਹ ਹੋ ਗਿਆ ਉਹਦੇ ਕਰਕੇ ਲੋਕ ਸੋਚਦੇ ਆ ਵੀ ਐਡਾ ਮਹਿੰਗਾ ਨਾਲੇ ਚੰਗਾ ਨਹੀਂ ਗਾ ਫਰੂਟ ਲਈਏ ਕਿਵੇਂ ਕਰੀਏ ਕਿਸੇ ਦੇ ਘਰ ਜਾਣਾ ਹੁੰਦਾ ਸੀ ਅੱਗੇ ਕਿਲੋ ਫਰੂਟ ਲੈ ਜਾਂਦੇ ਸੀ ਲੋਕ ਅੱਜ ਕੱਲ੍ਹ ਕਹਿੰਦੇ ਯਾਰ ਕਿਲੋ ਫਰੂਟ ਨਾਲ ਵੀ ਨਹੀਂ ਸਰਦਾ ਕਿਸੇ ਘਰ ਜਾਣਾ ਤਾਂ ਮਹਿੰਗਾਈ ਦਾ ਉਦੋਂ ਸਭ ਤੋਂ ਵੱਡਾ ਰੌਲਾ ਹੋ ਜਾਂਦਾ ਕਿ ਅਸੀਂ ਬੱਸਾਂ 'ਤੇ ਚੜ੍ਹਨਾ ਬੱਸਾਂ ਦੀ ਕਿਰਾਏ ਨਹੀਂ ਸਾਨੂੰ ਮਾਨ ਸਾਨੂੰ ਸਿਲੰਡਰ ਦੀ ਦਿੱਕਤ ਆ ਗਈ ਘਰ ਅਸੀਂ ਕੋਈ ਵੀ ਕੰਮ ਕਰਨਾ ਸਾਨੂੰ ਮਹਿੰਗਾਈ ਨੇ ਮਾਰ ਪਾ ਰੱਖੀ ਹੈ ਰਾਸ਼ਨ ਲੈ ਕੇ ਆਉਣਾ ਰਾਸ਼ਨ ਐਡਾ ਮਹਿੰਗਾ ਹਦੋਂ ਜ਼ਿਆਦਾ ਮਹਿੰਗਾ ਅਸੀਂ ਲੈ ਕੇ ਆਉਂਦੇ ਹਾਂ ਜਿਹੜਾ ਰਾਸ਼ਨ ਅਸੀਂ ਅੱਗੇ ਹਜ਼ਾਰ ਰੁਪਏ ਵਿੱਚ ਲੈ ਕੇ ਆਉਂਦੇ ਸੀ ਹੁਣ ਉਹੀ ਰਾਸ਼ਨ ਅਸੀਂ ਦੋ ਹਜ਼ਾਰ ਪੱਚੀ ਸੌ ਦੇ ਵਿੱਚ ਲੈ ਕੇ ਆਉਂਦੇ ਹਾਂ ਮਹਿੰਗਾਈ ਕਾਰਨ ਇੰਨਾਂ ਬਹੁਤ ਜ਼ਿਆਦਾ ਮਹਿੰਗਾਈ ਨੇ ਦਿਮਾਗ ਖਰਾਬ ਕੀਤਾ ਹੋਇਆ ਮਦਦ ਕਰਨ ਵਾਸਤੇ ਇਹ ਕਹਿ ਸਕਦੇ ਹਾਂ ਕਿ ਸਾਡੀ ਮਦਦ ਐਵੇਂ ਕੀਤੀ ਜਾ ਸਕਦੀ ਹੈ ਕਿ ਮਹਿੰਗਾਈ ਨੂੰ ਘਟਾਇਆ ਜਾਵੇ